ਪੁਰਾਣੀਆਂ ਪੀੜ੍ਹੀਆਂ ਅੱਜ ਦੀਆਂ ਪੀੜ੍ਹੀਆਂ ਨਾਲੋਂ ਜ਼ਿਆਦਾ ਧਾਰਮਿਕ ਸਨ ਜਦੋਂ ਸ਼ਹੀਦੀ ਦਿਹਾੜੇ ਚੱਲਦੇ ਸੀ ਉਸ ਟਾਈਮ ਲੋਕ ਪੂਰੇ ਸੱਤ ਸੱਤ ਦਿਨ ਕੁਛ ਖਾਂਦੇ ਨਹੀਂ ਸੀ ਔਰ ਧਰਤੀ 'ਤੇ ਬੈਠ ਕੇ ਧਰਤੀ ਅਤੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਬੈਠ ਕੇ ਪਾਠ ਪੂਜਾ ਕਰਦੇ ਸੀ ਔਰ ਕੁਛ ਵੀ ਮਿੱਠਾ ਮਿੱਠਾ ਇਹ ਦਿਨਾਂ 'ਚ ਕੋਈ ਖਾਇਆ ਨਹੀਂ ਸੀ ਜਾਂਦਾ ਅੱਜ ਦੇ ਦਿਨਾਂ 'ਚ ਲੋਕ ਧਾਰਮਿਕ ਦਿਨਾਂ ਨੂੰ ਕੁਛ ਸਮਝਦੇ ਨਹੀਂ ਹੈ ਜਿਵੇਂ ਕਿ ਧਾਰਮਿਕ ਦਿਨ ਹੁੰਦੇ ਹੈ ਤਾਂ ਉਹਨਾਂ ਦੇ ਦਿਨਾਂ ਸ਼ਹੀਦੀ ਦਿਹਾੜੇ ਦੇ ਦਿਨਾਂ ਦੇ ਵਿੱਚ ਵੀ ਵਿਆਹ ਸ਼ਾਦੀਆਂ ਰੱਖਦੇ ਆ ਪੂਰੇ ਜਸ਼ਨ ਮਨਾਏ ਜਾਂਦੇ ਹੈ ਸੋ ਇਹ ਜਿਹੀਆਂ ਬਹੁਤ ਸਾਰੀਆਂ ਗੱਲਾਂ ਉਹ ਦਿਨਾਂ 'ਚ ਲੋਕ ਨੀਚੇ ਥੱਲੇ ਧਰਤੀ 'ਤੇ ਬਿਸਤਰ ਵਿਛਾ ਕੇ ਸੌਂਦੇ ਸੀ ਅੱਜ ਕੱਲ੍ਹ ਤਾਂ ਕਿਸੇ ਨੂੰ ਇਹ ਗੱਲਾਂ ਯਾਦ ਹੀ ਨਹੀਂ ਰਹੀਆਂ ਸੋ ਇਹੋ ਜਿਹੀਆਂ ਕੁਛ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਪੁਰਾਣੀਆਂ ਪੀੜ੍ਹੀਆਂ ਆਪਣੀ ਕੋਮ ਵਾਸਤੇ ਮਰਨ ਵਾਸਤੇ ਗੁਰੁ ਦੇ ਲੜ੍ਹ ਲੱਗਣ ਵਾਸਤੇ ਬਹੁਤ ਜ਼ਿਆਦਾ ਤਿਆਰ ਰਹਿੰਦੀਆਂ ਸੀ ਅੱਜ ਕਲ੍ਹ ਦੀਆਂ ਪੀੜ੍ਹੀਆਂ ਨੂੰ ਦੇਖ ਕੇ ਸਭ ਗੱਲਾਂ ਬਹੁਤ ਮੁਸ਼ਕਿਲ ਹੈ ਮੌਡਰਨ ਹੋ ਗਏ ਹੈ ਲੋਕ ਗੁਰੂ ਗੁਰੂ ਘਰ ਜਾ ਕੇ ਸੇਵਾ ਕਰਨੀ ਜਾਂ ਗੁਰੂ ਦੇ ਲੜ੍ਹ ਲੱਗਣਾ ਅੱਜ ਕੱਲ੍ਹ ਦੇ ਲੋਕਾਂ ਨੂੰ ਲੱਗਦਾ ਕਿ ਇਹ ਫਿਜ਼ੂਲ ਦਾ ਕੰਮ ਹੈ ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਕੁਝ ਇੱਦਾਂ ਅੱਜ ਕੱਲ੍ਹ ਲੋਕ ਸੋਚਦੇ ਹੈ